ਭਾਰਤ ਨੌਕਰੀ ਬਾਜ਼ਾਰ ਛੋਟਾ ਹੈ ਭਾਰਤ ਵਿੱਚ ਨੌਕਰੀ ਲੈਣਾ ਪਹਿਲੇ ਸਮਿਆਂ ਵਿੱਚ ਥੋੜ੍ਹਾ ਸੌਖਾ ਹੁੰਦਾ ਸੀ ਪਰ ਹੁਣ ਬਹੁਤ ਔਖਾ ਹੈ ਇਸਦਾ ਇੱਕ ਕਾਰਣ ਵੱਧਦੀ ਹੋਈ ਆਬਾਦੀ ਵੀ ਹੈ ਆਬਾਦੀ ਭਾਰਤ ਵਿੱਚ ਦਿਨੋ ਦਿਨ ਵੱਧ ਰਹੀ ਹੈ ਪਰ ਨੌਕਰੀਆਂ ਸੀਮਿਤ ਹਨ ਜਿਸ ਕਾਰਣ ਬੇਜੁਰ ਬੇਰੋਜ਼ਗਾਰੀ ਵੱਧ ਰਹੀ ਹੈ ਨੌਕਰੀ ਲੈਣ ਸਮੇਂ ਇੱਕ ਆਮ ਮਨੁੱਖ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਭ ਤੋਂ ਪਹਿਲੀ ਚੁਣੌਤੀ ਤਾਂ ਉਚੱਜੀ ਵਿੱਦਿਆ ਹੈ ਜਿਹੜੇ ਲੋਕ ਗਰੀਬ ਹਨ ਅਤੇ ਫੀਸਾਂ ਨਹੀਂ ਭਰ ਸਕਦੇ ਉਹ ਲੋਕ ਫਿਰ ਨੌਕਰੀ ਤੋਂ ਵਾਂਝੇ ਰਹਿ ਜਾਂਦੇ ਹਨ ਦੂਜੀ ਚੁਣੌਤੀ ਹੈ ਮੁਕਾਬਲਾ ਭਾਰਤ ਵਿੱਚ ਆਬਾਦੀ ਜ਼ਿਆਦਾ ਹੋਣ ਕਰਕੇ ਜਦੋਂ ਵੀ ਦੋ ਸੌ ਨੌਕਰੀਆਂ ਨਿਕਲਦੀਆਂ ਹਨ ਉਹਨਾਂ ਲਈ ਦਸ ਹਜ਼ਾਰ ਬੰਦੇ ਪ੍ਰੀਖਿਆ ਦਿੰਦੇ ਹਨ ਜਿਸ ਨਾਲ ਨੌਕਰੀ ਲੱਗਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ ਦਸ ਹਜ਼ਾਰ ਵਿੱਚੋਂ ਸਿਰਫ਼ ਦੋ ਸੌ ਬੰਦੇ ਹੀ ਨੌਕਰੀ ਲੱਗ ਸਕਦੇ ਹਨ ਅਤੇ ਬਾਕੀ ਲੋਕ ਨੌਕਰੀ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਨਾਲ ਹੀ ਆਧੁਨਿਕ ਤਕਨੀਕਾਂ ਅਤੇ ਕੰਪਿਊਟਰ ਦੇ ਆਉਣ ਨਾਲ ਨਵੀਂ ਤੋਂ ਨਵੀਂ ਮਸ਼ੀਨਾਂ ਬਣ ਗਈਆਂ ਹਨ ਇਹ ਇੱਕ ਮਸ਼ੀਨ ਦਸ ਮਨੁੱਖਾਂ ਦਾ ਕੰਮ ਬੜੀ ਹੀ ਤੇਜ਼ੀ ਅਤੇ ਬਰੀਕੀ ਨਾਲ ਕਰ ਸਕਦੀ ਹੈ ਇਸ ਲਈ ਅਜੋਕੀ ਕੰਪਨੀਆਂ ਮਨੁੱਖਾਂ ਨੂੰ ਨੌਕਰੀ ਦੇਣ ਘਟਾ ਕੇ ਮਸ਼ੀਨਾਂ ਖਰੀਦ ਲੈਂਦੇ ਹਨ ਜਿਸ ਨਾਲ ਉਨਾਂ ਦੀ ਲਾਗਤ ਘੱਟ ਜਾਂਦੀ ਹੈ ਅਤੇ ਲਾਭ ਵਿੱਚ ਵਾਧਾ ਹੁੰਦਾ ਹੈ ਭਾਵ ਉਹਨਾਂ ਦੀ ਕਮਾਈ ਵਿੱਚ ਵਾਧਾ ਹੁੰਦਾ ਹੈ ਪਰ ਮਨੁੱਖਾਂ ਲਈ ਇਹ ਭਾਰੀ ਸਮੱਸਿਆ ਹੈ ਕਿਉਂਕਿ ਮਸ਼ੀਨਾਂ ਦੇ ਆਉਣ ਨਾਲ ਨੌਕਰੀਆਂ ਘੱਟ ਰਹੀਆਂ ਹਨ ਅਤੇ ਬੇਰੁਜ਼ਗਾਰੀ ਵੱਧ ਰਹੀ ਹੈ ਕੁਝ ਸਰਕਾਰੀ ਨੌਕਰੀਆਂ ਲਈ ਸਿਫਾਰਿਸ਼ ਲਗਵਾਉਣੀ ਪੈਂਦੀ ਹੈ ਜੋ ਲੋਕ ਸਿਫਾਰਿਸ਼ ਲਗਾ ਨਹੀਂ ਸਕਦੇ ਜਾਂ ਰਿਸ਼ਵਤ ਨਹੀਂ ਦੇ ਸਕਦੇ ਉਹਨਾਂ ਲੋਕਾਂ ਦੀ ਨੌਕਰੀ ਨਹੀਂ ਲੱਗਦੀ ਜੋ ਲੋਕ ਸਿਫਾਰਿਸ਼ ਲਗਵਾ ਲੈਂਦੇ ਹਨ ਉਹਨਾਂ ਨੂੰ ਨੌਕਰੀ ਅਸਾਨੀ ਨਾਲ ਮਿਲ ਜਾਂਦੀ ਹੈ ਅਤੇ ਬਾਕੀ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਲੋਕ ਨੌਕਰੀ ਤੋਂ ਵਾਂਝੇ ਰਹਿ ਜਾਂਦੇ ਹਨ ਅਗਰ ਕਿਸੇ ਨੂੰ ਲ ਲੇਬਰ ਦੀ ਨੌਕਰੀ ਲੱਗ ਵੀ ਜਾਵੇ ਤਾਂ ਉਸਨੂੰ ਤਨਖਾਹ ਘੱਟ ਮਿਲਦੀ ਹੈ ਅਤੇ ਬਹੁਤ ਜ਼ਿਆਦਾ ਕੰਮ ਕਰਾਵਾਇਆ ਜਾਂਦਾ ਹੈ ਅਗਰ ਕੋਈ ਤਨਖਾਹ ਵਧਾਉਣ ਲਈ ਜਾਂ ਕੰਮ ਘਟਾਉਣ ਲਈ ਕਹੇ ਤਾਂ ਉਸਨੂੰ ਨੌਕਰੀ ਤੋਂ ਕੱਢ ਵੀ ਦਿੱਤਾ ਜਾਂਦਾ ਹੈ ਕਿਉਂਕਿ ਬੇਰੋਜ਼ਗਾਰ ਲੋਕ ਦੀ ਭਰ ਭਾਰਤ ਵਿੱਚ ਕੋਈ ਕਮੀ ਨਹੀਂ ਲੋਕ ਘੱਟ ਤਨਖਾਹ ਵਿੱਚ ਵੀ ਵੱਧ ਕੰਮ ਕਰਨ ਲਈ ਮਜਬੂਰ ਹਨ